ਅਜੇ ਇਹ ਕੱਲ੍ਹ ਠੀਕ ਲੱਗਦੀ ਹੈ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਆਫਤਾਂ ਅਤੇ ਪੇਂਡੂ ਖੇਤਰ ਦੇ ਲੋਕਾਂ ਲਈ ਬਰਾਬਰ ਮੌਕੇ ਹਨ ਇਹਦੇ ਦੋ ਹੀ ਅਲਟਰੇਟ ਹਨ ਅਗਰ ਤਾਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਆਸ ਪਾਸ ਜਿਹੜਾ ਏਰੀਆ ਹੈਗਾ ਉਥੇ ਪ੍ਰੋਪਰ ਰਿਸੋਰਸ ਹੈਗੇ ਨੇ ਔਰਤਾਂ ਵਾਸਤੇ ਜਾਂ ਪੇਡੂ ਖੇਤਰਾਂ ਲੋਕਾਂ ਲਈ ਫਿਰ ਤਾਂ ਬਹੁਤ ਅੱਛੀ ਗੱਲ ਹੈ ਅਤੇ ਕਈ ਵਾਰ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਿਮੋਟ ਏਰੀਆ 'ਚ ਉਥੇ ਕਾਲਜ ਖੋਲ ਦਿੱਤੇ ਜਾਂਦੇ ਹਨ ਪਰ ਉਥੇ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ ਉਸ ਤਰ੍ਹਾਂ ਦੇ ਇੰਸਟਰੂਮੈਂਟ ਨਹੀਂ ਮਿਲ ਪਾਂਦੇ ਜਾਂ ਕੋਈ ਹੋਰ ਟੈਕਨੀਕਲ ਜਿਹੜੇ ਟੂਲ ਉਹ ਨਹੀਂ ਮਿਲ ਪਾਂਉਦੇ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਅਤੇ ਵੈਸੇ ਪਰ ਫਿਰ ਵੀ ਜੋ ਸਰਕਾਰ ਨੇ ਇਹ ਯੂਨੀਵਰਸਿਟੀਆਂ ਖੋਲੀਆਂ ਅਤੇ ਬਰਾਬਰ ਮੌਕਾ ਦਿੱਤਾ ਹੈ ਔਰਤਾਂ ਔਰਤਾਂ ਨੂੰ ਇਹ ਬਹੁਤ ਵਧੀਆ ਗੱਲ ਹੈਗੀ ਏ ਅਤੇ ਇਸ ਤਰ੍ਹਾਂ ਦੇ ਮੌਕੇ ਮਿਲਣੇ ਚਾਹੀਦੇ ਹਨ